ਪਹਿਲਾਂ ਜ਼ਮਾਨੇ ਵਿੱਚ ਲੋਕ ਬਹੁਤ ਸਾਰੀਆਂ ਖੇਡਾਂ ਖੇਡਦੇ ਸੀਗੇ ਜਿਵੇਂ ਹੁੱਕਾ ਪੀਂਦੇ ਸੀ ਉਹ ਜੂਆ ਖੇਡਦੇ ਸੀਗੇ ਤਾਸ਼ ਖੇਡਦੇ ਸੀ ਪੱਤੇ ਖੇਡਦੇ ਸੀਗੇ ਪੈਸੇ ਲਾਉਂਦੇ ਸੀਗੇ ਘੋਲ ਕਰਦੇ ਸੀਗੇ ਰੇਸ ਘੋੜੀਆਂ ਦੀਆਂ ਰੇਸਾਂ ਕਰਦੇ ਸੀਗੇ ਘੁਲਣਾ ਇਹ ਸਭ ਉਨ੍ਹਾਂ ਨੂੰ ਬਹੁਤ ਪਸੰਦ ਸੀਗਾ ਅਤੇ ਹੁਣ ਦੇ ਜ਼ਮਾਨੇ ਵਿੱਚ ਵੀ ਬਹੁਤ ਸਾਰੇ ਬਜ਼ੁਰਗ ਅਜਿਹੇ ਨੇ ਗੇ ਜਿਹੜੇ ਜਿਨ੍ਹਾਂ ਨੂੰ ਕਿ ਪੱਤੇ ਖੇਡਣ ਦਾ ਬਹੁਤ ਸ਼ੌਂਕ ਹੈਗਾ ਗੋਲੀਆਂ ਖੇਡਣ ਦਾ ਬਹੁਤ ਸ਼ੌਂਕ ਹੈਗਾ ਅਤੇ ਬਹੁਤ ਸਾਰੇ ਜਿਹੜੇ ਬਜ਼ੁਰਗ ਹੁੰਦੇ ਸੀਗੇ ਉਹ ਗਲਤ ਖੇਡਾਂ ਵੀ ਖੇਡਦੇ ਸੀ ਜਿਵੇਂ ਜੂਆ ਖੇਡਣਾ ਜਾਂ ਪੱਤੇ ਲਾਉਣਾ ਅਤੇ ਪਿਛਲੇ ਪਹਿਲਾਂ ਜ਼ਮਾਨੇ ਵਿੱਚ ਲੋਕ ਮੁਰਗਿਆਂ ਦੀਆਂ ਮੁਰਗਿਆਂ ਦੀਆਂ ਲੜਾਈਆਂ ਕਰਵਾਉਂਦੇ ਸੀਗੇ ਆਹਾ ਕਬੂਤਰਾਂ ਦੀਆਂ ਬਾਜੀਆਂ ਲਵਾਉਂਦੇ ਸੀਗੇ ਅਤੇ ਘੋੜਿਆਂ ਦੀਆਂ ਰੇਸਾਂ ਕਰਵਾਉਂਦੇ ਸੀਗੇ ਅਤੇ ਉਹ ਘੋਲ ਵੀ ਕਰਦੇ ਸੀਗੇ ਅਤੇ ਬਹੁਤ ਅਤੇ ਹੁਣ ਵੀ ਲੋਕ ਇਹ ਇਹ ਸਭ ਮੇਲਿਆਂ ਵਿੱਚ ਕਰਦੇ ਨੇ ਗੇ ਬਜ਼ੁਰਗਾਂ ਨੂੰ ਇਹ ਸਭ ਦੇਖਣ ਦਾ ਬਹੁਤ ਸ਼ੌਂਕ ਹੈਗਾ ਉਹ ਹੁੱਕਾ ਲਾਉਂਦੇ ਲੌਂਗੇ ਲਾਉਂਦੇ ਲਾਉਂਦੇ ਜਿਵੇਂ ਤਾਸ਼ ਖੇਡਦੇ ਸੀਗੇ ਜਾਂ ਇਹਾ ਜਿਹਾ ਕੁਛ ਕਰਦੇ ਸੀ ਧੰਨਵਾਦ